ਹੈਲੋ ਫਲਿੱਪਗਾਰਡ ਤੋਂ ਬੋਲ ਰਹੇ ਹੋ ਭਾਅ ਜੀ ਜੀ ਭਾਅ ਜੀ ਹਾਂਜੀ ਇਹ ਏ ਸੀ ਦਾ ਏ ਸੀ ਦੇ ਐਕਸਪੀਰੀਅੰਸ ਬਾਰੇ ਦੱਸਣਾ ਚਾਹੁੰਦੇ ਹਾਂ ਤੁਹਾਨੂੰ ਕਿ ਅਸੀਂ ਤੁਹਾਡੇ ਤੋਂ ਏ ਸੀ ਮੰਗਵਾਇਆ ਸੀ ਜੀ ਬਹੁਤ ਵਧੀਆ ਕੁਆਲਿਟੀ ਆ ਮਾਰਕੀਟ ਦੇ ਵਿੱਚ ਅਵੇਲੇਬਲ ਨਹੀ ਫਿਰ ਵੀ ਤੁਸੀਂ ਸਾਨੂੰ ਜੋ ਆ ਮੁਹੱਈਆ ਕਰਵਾਇਆ ਟਾਈਮ 'ਤੇ ਤੁਹਾਡੀ ਡਿਲੀਵਰੀ ਪਹੁੰਚ ਗਈ ਹਾਂਜੀ ਅੱਛੀ ਕੂਲਿੰਗ ਹੈ ਬਿਗ ਹਾਲ ਬਹੁਤ ਵੱਡਾ ਹਾਲ ਹੈ ਸਾਡਾ ਜਿਹਦੇ ਵਿੱਚ ਬਹੁਤ ਜਲਦੀ ਕੂਲਿੰਗ ਠੰਢਕ ਜਿਹੜੀ ਆ ਉਹ ਪਹੁੰਚਾ ਦਿੰਦਾ ਵਾ ਜੀ ਅੱਗੇ ਵੀ ਅਸੀਂ ਹੋਰ ਕੁਛ ਕੰਪਨੀਆਂ ਤੋਂ ਮੰਗਵਾਉਂਦੇ ਪਏ ਸੀਗੇ ਪਰ ਉਹ ਕੁਆਲਿਟੀ ਵਧੀਆ ਨਹੀਂ ਸੀ ਦਿੰਦੇ ਤੁਹਾਡੀ ਕੁਆਲਿਟੀ ਵੀ ਵਧੀਆ ਵਾ ਅਤੇ ਡਿਲੀਵਰੀ ਟਾਈਮ ਵੀ ਜਿਹੜਾ ਵਾ ਸਹੀ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਜਿਹੜਾ ਵਾ ਪ੍ਰੋਡਕਟ ਮੰਗਵਾਇਆ ਕਰਾਂਗੇ ਜੀ ਚੰਗੀ ਕੁਆਲਿਟੀ ਮਿਲ ਜਾਵੇ ਅਤੇ ਸਹੀ ਸਮੇਂ ਡਿਲੀਵਰੀ ਮਿਲ ਜਾਵੇ ਹੋਰ ਆਪਾਂ ਨੂੰ ਭਾਅ ਜੀ ਚਾਹੀਦਾ ਵੀ ਕੀ ਆ ਜੀ ਥੈਂਕ ਯੂ ਭਾਅ ਜੀ ਮਿਹਰਬਾਨੀ ਭਾਅ ਜੀ